ਯੋਗਾ ਹੀ ਹੈਗੀ ਆ ਜੋ ਸਾਡੇ ਜੀਵਨ ਨੂੰ ਸੰਤੁਲਿਤ ਬਣਾਉਂਦੀ ਹੈ ਵ ਯੋਗਾਂ ਤੋਂ ਬਿਨਾਂ ਆਪਾਂ ਕੁਛ ਵੀ ਹਾਸਿਲ ਨਹੀਂ ਕਰ ਸਕਦੇ ਯੋਗਾ ਕਰਨ ਨਾਲ ਆਪਾਂ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਅਤੇ ਕੇਂਦਰਿਤ ਕਰ ਸਕਦੇ ਹਾਂ ਅਤੇ ਕੋਈ ਵੀ ਕੰਮ ਨੂੰ ਅਧੂਰਾ ਨਹੀਂ ਛੱਡ ਸਕਦੇ ਯੋਗਾ ਕਰਨ ਨਾਲ ਸਾਡੀ ਸਿਹਤ ਚੰਗੀ ਹੋ ਜਾਂਦੀ ਹੈ ਅਤੇ ਸਾਡਾ ਮਨੋਬਲ ਵੱਧ ਜਾਂਦਾ ਹੈ ਅਤੇ ਸਾਨੂੰ ਹਰ ਚੀਜ਼ ਵਧੀਆ ਲੱਗਣ ਲੱਗ ਜਾਂਦੀ ਹੈ ਯੋਗਾ ਕਰਨ ਨਾਲ ਆਪਣੀ ਅਸੀਂ ਆਪਣੇ ਜੀਵਨ ਦੀਆਂ ਸਾਰੀਆਂ ਹੀ ਮੁਸ਼ਕਿਲਾਂ ਨੂੰ ਦੂਰ ਕਰ ਸਕਦੇ ਹਾਂ ਯੋਗਾ ਕਰਨ ਨਾਲ ਸਾਡਾ ਸਰੀਰ ਹੋਰ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਅਤੇ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦਾ ਹੈ ਯੋਗਾ ਕਰਨ ਨਾਲ ਸਾਨੂੰ ਅਧੂਰੀਆਂ ਬਿਮਾਰੀਆਂ ਤਾਂ ਦੂਰ ਹੋ ਜਾਂਦੀਆਂ ਹਨ ਯੋਗਾ ਦੇ ਵਿੱਚ ਸਾਨੂੰ ਆਪਣੇ ਮਨ ਨੂੰ ਕੇਂਦਰਿਤ ਕਰਨਾ ਸਿਖਾਇਆ ਜਾਂਦਾ ਹੈ ਆਪਾਂ ਯੋਗਾ ਦਾ ਕੰਮ ਨਿੱਜੀ ਜੀਵਨ ਵਿੱਚ ਵੀ ਕਰ ਸਕਦੇ ਹਾਂ ਯੋਗਾ ਇੱਕ ਉਹ ਕਲਾ ਹੈਗੀ ਹੈ ਜੋ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਜੋ ਲੋਕੀ ਯੋਗਾ ਕਰਦੇ ਸੀ ਆਪਣੇ ਮਨ ਨੂੰ ਕੇਂਦਰਿਤ ਕਰਦੇ ਸੀ ਅਤੇ ਪ੍ਰਭੂ ਦੇ ਧਿਆਨ ਨਾਲ ਮਗਨ ਹੁੰਦੇ ਸੀ ਉਸ ਸਮੇਂ ਉਹਨੂੰ ਯੋਗਾ ਕਿਹਾ ਜਾਂਦਾ ਸੀ ਪਰ ਅੱਜ ਸਮੇਂ ਯੋਗਾ ਦੇ ਅਲੱਗ ਅਲੱਗ ਕਿਰਿਆਵਾਂ ਹੁੰਦੀਆਂ ਹਨ ਕੋਈ ਯੋਗਾ ਮਨ ਨੂੰ ਸੰਤੁਲਿਤ ਕਰਨ ਵਾਸਤੇ ਕੀਤਾ ਜਾਂਦਾ ਹੈ ਅਤੇ ਕੋਈ ਯੋਗਾ ਸਿਹਤ ਨੂੰ ਸੰਤੁਲਿਤ ਕਰਨ ਵਾਸਤੇ ਕੀਤਾ ਜਾਂਦਾ ਹੈ ਯੋਗਾ ਇੱਕ ਵਧੀਆ ਹੀ ਪਰਉਪਕਾਰੀ ਤੋਹਫਾ ਹੈ ਜੋ ਸਾਨੂੰ ਜੋ ਲੋਕਾਂ ਦੇ ਦੁਆਰਾ ਮਿਧਿਆ ਗਿਆ ਹੈ ਯੋਗਾ ਕਰਨ ਨਾਲ ਆਪਾਂ ਆਪਣੇ ਸਰੀਰ ਦਾ ਮਨੋਬਲ ਵਧਾ ਸਕਦੇ ਹਾਂ ਸਰੀਰ ਦੀ ਬਿਮਾਰੀ ਨੂੰ ਦੂਰ ਕਰ ਸਕਦੇ ਹਾਂ ਇਹ ਯੋਗਾ ਕਰਨ ਦਾ ਮੈਨੂੰ ਮੌਕਾ ਮਿਲਿਆ ਸੀਗਾ ਯੋ ਆਪਣੇ ਪੁਰਾਣੇ ਜ਼ਮਾਨੇ ਦੇ ਲੋਕਾਂ ਕੋਲੋਂ ਜੋ ਯੋਗਾ ਕਰਦੇ ਸੀ ਅਤੇ ਆਪਣੇ ਮਨੋਬਲ ਨੂੰ ਵਧਾਉਂਦੇ ਸੀ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਆ ਯੋਗਾ ਕਰਨ ਨਾਲ ਬਹੁਤ ਸਾਰੀ ਬਿਮਾਰੀਆਂ ਨੂੰ ਦੂਰ ਕਰਦੇ ਹਾਂ ਯੋਗਾ ਇਕ ਬਹੁਤ ਵਧੀਆ ਹੀ ਕਲਾ ਹੈ ਜੋ ਹਰ ਵਿਅਕਤੀ ਨੂੰ ਅਪਣਾਉਣੀ ਚਾਹੀਦੀ ਹੈ ਇਹ ਮਨ ਨੂੰ ਕੇਂਦਰਿਤ ਕਰਦਾ ਹੈ ਅਤੇ ਮਨ ਦਾ ਪਰਫਨ ਬਣਾਉਂਦਾ ਹੈ ਧੰਨਵਾਦ